ਹਾਂਜੀ ਤੁਸੀਂ ਈ ਸਕੂਲ ਆਈਲੈਟਸ ਸੈਂਟਰ ਤੋਂ ਗੱਲ ਕਰ ਰਹੇ ਹੋ ਮੈਮ ਮੈਂ ਆਇਲਸ ਦਾ ਕੋਰਸ ਕਰਨਾ ਚਾਹੁੰਦੀ ਸੀ ਹਾਂਜੀ ਹਾਂਜੀ ਨਹੀਂ ਸ਼ਡਿਊਲ ਨਹੀਂ ਮੈਮ ਪਹਿਲਾਂ ਮੈਨੂੰ ਇਹ ਤੁਸੀਂ ਇਹ ਦੱਸੋ ਕਿ ਕਿੰਨੇ ਟਾਈਮ ਪੀਰੀਅਡ ਦਾ ਹੋਊਗਾ ਇਹ ਕੋਰਸ ਕਿੰਨੇ ਟਾਈਮ ਦਾ ਹਾਂਜੀ ਅੱਛਾ ਜੀ ਠੀਕ ਕਿਹੜੀ ਕਿਹੜੀ ਮਤਲਬ ਕ ਕਿਹੜੀ ਕਿਹੜੀ ਕਲਾਸ ਹੋਊਗੀ ਦੱਸ ਸਕਦੇ ਹੋ ਤੁਸੀਂ ਅੱਛਾ ਜੀ ਅਤੇ ਸਾਰੀ ਕਲਾਸਿਸ ਦਾ ਮੈਡਮ ਟੋਟਲ ਟਾਈਮਿੰਗ ਮਤਲਬ ਕਿੰਨੀ ਹੋ ਸਕਦੀ ਹੈ ਪੂਰੇ ਦਿਨ 'ਚ ਠੀਕ ਹੈ ਔਰ ਮੈਡਮ ਕੀ ਮਤਲਬ ਰੇਟ ਕੀ ਹੈ ਚਾਰਜਿਸ ਫੀਸ ਕੀ ਹੈ ਤੁਹਾਡੀ ਅੱਛਾ ਜੀ ਕੋਈ ਡਿਸਕਾਊਂਟ ਨਹੀਂ ਮਿਲ ਸਕਦਾ ਮੈਡਮ ਅੱਛਾ ਜੀ ਠੀਕ ਹੈ ਮੈਡਮ ਔਰ ਮਤਲਬ ਮੈਂ ਕਦੋਂ ਤੋਂ ਸਟਾਰਟ ਕਰ ਸਕਦੀ ਹਾਂ ਅੱਛਾ ਜੀ ਅਤੇ ਹਾਂਜੀ ਅਤੇ ਮੈਡਮ ਨੋਟਸ ਵਗੈਰਾ ਪ੍ਰੋਵਾਈਡ ਕਰਵਾਉਂਦੇ ਤੁਸੀਂ ਸਾਰਾ ਕੁਛ ਅੱਛਾ ਜੀ ਠੀਕ ਹੈ ਮੈਡਮ ਫੇਰ ਮੈਂ ਕਿੰਨੇ ਵਜੇ ਆਵਾਂ ਤੁਹਾਡੇ ਕੋਲ ਅੱਛਾ ਜੀ ਕਿੰਨੇ ਵਜੇ ਤੱਕ ਔਫਿਸ ਖੁੱਲ੍ਹਾ ਰਹਿੰਦਾ ਜੀ ਅੱਛਾ ਜੀ ਦਸ ਤੋਂ ਪੰਜ ਹੈਂਜੀ ਠੀਕ ਹੈ ਮੈਡਮ ਓਕੇ ਮੈਡਮ ਚਲੋ ਠੀਕ ਹੈ ਮੈਂ ਮਿਲਦੀ ਹਾਂ ਫੇਰ